ਸਕੂਲਾਂ ਵਿੱਚ ਤਿੰਨ ਲੈਂਗੁਏਜਿਸ ਪੰਜਾਬੀ ਹਿੰਦੀ ਇੰਗਲਿਸ਼ ਮੈਥ ਸੋ ਸਟੱਡੀ ਫਿਜ਼ੀਕਲ ਐਜੂਕੇਸ਼ਨ ਕੰਪਿਊਟਰ ਸਾਇੰਸ ਆਦਿ ਸਬਜੈਕਟ ਪੜ੍ਹਾਏ ਜਾਂਦੇ ਹਨ ਸਰਕਾਰੀ ਸਕੂਲਾਂ ਵਿੱਚ ਜੋ ਅਧਿਆਪਕ ਹਨ ਉਹ ਹਾਈਲੀ ਕੁਆਲੀਫਾਈਡ ਹੁੰਦੇ ਹਨ ਉਹਨਾਂ ਦੀ ਐਜੂਕੇਸ਼ਨ ਬਹੁਤ ਵਧੀਆ ਹੁੰਦੀ ਹੈ ਉਹਨਾਂ ਦੀ ਸਲੈਕਸ਼ਨ ਵੀ ਉਹਨਾਂ ਦੀ ਕਾਬਲੀਅਤ 'ਤੇ ਹੀ ਨਿਰਭਰ ਹੁੰਦੀ ਹੈ ਉਹ ਅਧਿਆਪਕ ਬਹੁਤ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਪੜ੍ਹਾ ਸਕਦੇ ਹਨ ਬੱਚਿਆਂ ਨੂੰ ਲੇਕਿਨ ਪ੍ਰਾ ਜੋ ਪ੍ਰਾਈਵੇਟ ਸਕੂਲ ਹਨ ਉਹਨਾਂ ਵਿੱਚ ਅਧਿਆਪਕਾਂ ਦੀਆਂ ਤਨਖਾਹਵਾਂ ਥੋੜ੍ਹੀਆਂ ਹਨ ਅਤੇ ਉਹਨਾਂ ਦੀ ਕੁਆਲੀਫਿਕੇਸ਼ਨ ਵੀ ਘੱਟ ਹੁੰਦੀ ਹੈ ਉਸਦੇ ਮੁਕਾਬਲੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਜ਼ਿਆਦਾ ਪੜ੍ਹੇ ਲਿਖੇ ਹਨ ਲੇਕਿਨ ਫਿਰ ਵੀ ਲੋਕਾਂ ਦਾ ਰੁਝਾਨ ਪਤਾ ਨਹੀਂ ਕਿਉਂ ਅੰਗਰੇਜ਼ੀ ਸਕੂਲਾਂ ਵੱਲ ਹਨ ਵੱਲ ਹੈ ਅੰਗਰੇਜ਼ੀ ਸ਼ਾਇਦ ਉਹਨਾਂ ਦੇ ਮਨ ਵਿੱਚ ਹੈ ਕਿ ਅੰਗਰੇਜ਼ੀ